ਅਸੀਂ ਗਏ ਮਾਲ ਰੋਡ ਮਨਾਲੀ ਉੱਥੇ ਜਾ ਅਨੰਦ ਬਹੁਤ ਆਇਆ ਘੁੰਮ ਫਿਰ ਕੇ ਅਤੇ ਉੱਚੇ ਉੱਚੇ ਪਹਾੜੀਆਂ ਚੜ੍ਹੇ ਗੱਡੀ ਦੇ ਵਿੱਚ ਡਰ ਵੀ ਲੱਗਿਆ ਅਨੰਦ ਵੀ ਬਹੁਤ ਆਇਆ ਮਨਾਲੀ ਤੋਂ ਅਸੀਂ ਚੱਲ ਗਏ ਅੱਗੇ ਹੋਰਤਾਂਗ ਰੋਹਤਾਂਗ ਜਾ ਕੇ ਉੱਪਰ ਬਰਫ਼ ਪਈ ਵੀ ਸੀ ਜਦੋਂ ਬਰਫ਼ ਪਈ ਵੀ ਸੀ ਤਾਂ ਬਹੁਤ ਆਨੰਦ ਆਇਆ ਉੱਥੇ ਸੇਬਾਂ ਦੇ ਪਹਾੜ ਯੋਕ ਦੇਖਣ ਨੂੰ ਮਿਲੇ ਸੋਹਣੇ ਸੋਹਣੇ ਕੁੱਤੇ ਦੇਖਣ ਨੂੰ ਮਿਲੇ ਬੰਦੇ ਇਨਸਾਨ ਬਹੁਤ ਬ ਬ ਵਧੀਆ ਅਤੇ ਜਾ ਕੇ ਆਨੰਦ ਬਹੁਤ ਵਧੀਆ ਆਇਆ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਉੱਚੀ ਉੱਚੀ ਪਹਾੜੀਆਂ ਉੱਪਰ ਬਰਫ਼ ਪਈ ਵੀ ਅਤੇ ਅਸੀਂ ਫਰੈਂਡ ਉੱਪਰ ਉੱਥੇ ਸਿਲੰਡਰ ਮੈਗੀ ਬਣਾਈ ਮੈਗੀ ਖਾਧੀ ਯਾਨੀ ਕਿ ਇੰਜੋਆਏ ਬਹੁਤ ਵਧੀਆ ਕੀਤਾ ਅਸੀਂ ਉੱਥੇ ਜਾ ਕੇ